ਸਿੱਖਿਅਤ ਲੈਣਾ ਇੱਕ ਆਪਣੀ ਜ਼ਿੰਦਗੀ ਵਿੱਚ ਬਹੁਤ ਮਦਦ ਕਰ ਰਿਹਾ ਆਪਣੀ ਕਿਸੇ ਵੀ ਚੀਜ਼ ਦੀ ਸਿੱਖਿਆ ਲੈਣਾ ਜਾਂ ਕੋਈ ਕੰਮ ਸਿੱਖਣਾ ਜਿਵੇਂ ਕਿ ਕਿਸੇ ਵੀ ਚੀਜ਼ ਦਾ ਜਿਵੇਂ ਕਿ ਹੁਣ ਅੱਜ ਕੱਲ ਕੁਕਿੰਗ ਦਾ ਕੰਮ ਸਿੱਖਣਾ ਹੈਗਾ ਤਾਂ ਕੁਕਿੰਗ ਦੀ ਡਿਗਰੀ ਹੈ ਜਿਹੜੀ ਉਹ ਆਉਂਦੀ ਹੈ ਉਹ ਆਪਣੇ ਫੋਰਨ ਦੇ ਵਿੱਚ ਵੀ ਕੰਮ ਦਿੰਦੀ ਹੈਗੀ ਕੁਕਿੰਗ ਦਾ ਕੰਮ ਸਿੱਖਣਾ ਜਾਂ ਕੋਈ ਹੋਰ ਕਿਸੇ ਮਿਸਤਰੀ ਤੋਂ ਲੱਕੜ ਦਾ ਕੰਮ ਸਿੱਖਣਾ ਅਤੇ ਜਾਂ ਕਿ ਆਪਾਂ ਕਿਸੇ ਵੀ ਚੀਜ਼ ਦੀ ਆਈ ਟੀ ਆਈ ਕਰਕੇ ਹੈ ਨਾ ਜਾਂ ਬਿਜਲੀ ਦੀ ਇਲੈਕਟਰੋਨਿਕ ਦੀ ਆਈ ਟੀ ਆਈ ਕਰਕੇ ਉੱਦੂ ਬਾਅਦ ਆਪਾਂ ਉਸਦਾ ਕੰਮ ਸਿੱਖਦੇ ਹਾਂ ਪ੍ਰੈਕਟੀਕਲ ਤੌਰ 'ਤੇ ਉਹ ਵੀ ਇੱਕ ਸਿੱਖਿਆ ਤੋਂ ਲੈ ਕੇ ਆਪਣੇ ਅੱਗੇ ਵੀ ਮਦਦ ਆਪਣੀ ਹਰੇਕ ਥਾਂ ਕਰਦਾ ਕਿਸੇ ਸਰਕਾਰੀ ਅਦਾਰੇ 'ਤੇ ਵੀ ਕਰਦਾ ਹੈ ਕਿਉਂਕਿ ਜੇ ਆਪਾਂ ਕਿਸੇ ਵੀ ਚੀਜ਼ ਦੀ ਆਈ ਟੀ ਆਈ ਕਰਦੇ ਹਾਂ ਤਾਂ ਉਸਦਾ ਕੰਮ ਸਿੱਖਦੇ ਹਾਂ ਇਲੈਕਟਰੋਨਿਕ ਆਈ ਟੀ ਆਈ ਮੰਨ ਲਓ ਬਿਜਲੀ ਦਾ ਕੰਮ ਸਿੱਖਦੇ ਹਾਂ ਤਾਂ ਉਸ ਤੋਂ ਬਾਅਦ ਉਹ ਆਪਾਂ ਕਿਸੇ ਵੀ ਕਿਸੇ ਬਿਜਲੀ ਮਹਿਕਮੇ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਆਪਣੀ ਉਹ ਡਾਕੂਮੈਂਟ ਲੱਗਦੇ ਨੇ ਅਤੇ ਆਪਣਾ ਬਹੁਤ ਹੀ ਕੰਮ ਜਿਹੜਾ ਆਸਾਨ ਹੋ ਜਾਂਦਾ ਉਸ ਨਾਲ ਕੁਛ ਨਾ ਕੁਛ ਇਹ ਅਨਪੜ੍ਹ ਲੋਕਾਂ ਨੂੰ ਇਸ ਚੀਜ਼ਾਂ ਦਾ ਜਿਹੜਾ ਕਿ ਸਾਹਮਣਾ ਬਹੁਤ ਕਰਨਾ ਪੈਂਦਾ ਕਿਉਂਕਿ ਅਨਪੜ੍ਹ ਲੋਕਾਂ ਦੀ ਪੜ੍ਹਾਈ ਘੱਟ ਹੋਣ ਦੇ ਕਾਰਨ ਉਹ ਸਿਰਫ ਹੱਥੀਂ ਹੀ ਕੰਮ ਕਰ ਸਕਦੇ ਨੇ ਆਪਦਾ ਕੋਈ ਨਾ ਕੋਈ ਕੰਮ ਜਿਹੜਾ ਕਿ ਛੋਟਾ ਮੋਟਾ ਕੰਮ ਹੀ ਕਰ ਸਕਦੇ ਨੇ ਇਸ ਕਰਕੇ ਉਹਨਾਂ ਤੋਂ ਜਿਹੜਾ ਕਿ ਉਹ ਕਈ ਚੀਜ਼ਾਂ ਖੁੰਝ ਜਾਂਦੀਆਂ ਨੇ ਅਨਪੜ੍ਹ ਦੇ ਨਾਲ ਨਾਲ ਵੀ ਜਿਵੇਂ ਕਿ ਕਾਰਪੈਂਟਰ ਦਾ ਕੰਮ ਸਿੱਖਣਾ ਕੋਈ ਲੱਕੜ ਦਾ ਕੰਮ ਸਿੱਖਣਾ ਗਾ ਉਹ ਬਸ ਉੱਥੋਂ ਤੱਕਰ ਪਿੰਡ ਦੇ ਲੈਵਲ ਤੱਕ ਹੀ ਸੀਮਿਤ ਰਹਿੰਦੇ ਨੇ ਇਸ ਤੋਂ ਅਗਾਂਹ ਨਹੀਂ ਜਾ ਸਕਦੇ ਹੁੰਦੇ ਅਤੇ ਜਾਣੀ ਕਿ ਕੋਈ ਪੇਂਟਿੰਗ ਪ ਕੋਈ ਦਰ ਦੀਵਾਰਾਂ ਨੂੰ ਰੰਗ ਰੋਗਨ ਕਰਨਾ ਤਾਂ ਉਹ ਇੱਕ ਅਨਪੜ੍ਹ ਥੋੜ੍ਹੇ ਮੋਟੇ ਪੜ੍ਹੇ ਲੋਕਾਂ ਦਾ ਹੀ ਕੰਮ ਹੁੰਦਾ ਹੈ ਦਿਹਾੜੀਦਾਰ ਲੋਕਾਂ ਦਾ ਹੀ ਕੰਮ ਹੁੰਦਾ ਹੈ ਅਤੇ ਇਸ ਤਰ੍ਹਾਂ ਉਹਨਾਂ ਤੋਂ ਵੀ ਕਈ ਕੰਮ ਜਿਹੜੇ ਹੈਗੇ ਨੇ ਪੜ੍ਹੇ ਲਿਖਿਆਂ ਲਈ ਖੁੰਝ ਜਾਂਦੇ ਨੇ ਉਹਨਾਂ ਨੂੰ ਇਸ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਵੀ ਜਿਹੜਾ ਕਿ ਸਿੱਖਿਅਤ ਹੋਣਾ ਅਤੇ ਅਨਪੜ੍ਹ ਹੋਣਾ ਇਹੀ ਇਸ 'ਚ ਫਰਕ ਹੈ ਠੀਕ ਹੈ